ਭੰਗੜਾ ਐਰੋਬਿਕਸ ਸਰੀਰਿਕ ਗਤੀਵਿਧੀ ਦੇ ਤੌਰ 'ਤੇ ਬਹੁਤ ਵਧੀਆ ਹੀ ਕਸਰਤ ਹੈ ਮੈਨੂੰ ਕੁਝ ਅਰਸਾ ਪਹਿਲਾਂ ਗਠੀਏ ਦੀ ਬਿਮਾਰੀ ਸੀ ਔਰ ਮੈਨੂੰ ਡਾਕਟਰ ਨੇ ਇੱਕ ਸਾਲ ਦਵਾਈ ਖਾਣ ਲਈ ਕਿਹਾ ਪਹਿਲਾਂ ਉਹਨੇ ਦੋ ਮਹੀਨੇ ਦੀ ਦਿੱਤੀ ਫਿਰ ਚਾਰ ਮਹੀਨੇ ਦੀ ਦਿੱਤੀ ਔਰ ਹਮੇਸ਼ਾ ਦੀ ਤਰ੍ਹਾਂ ਕਿ ਡੋਜਿਜ ਘਟਾ ਦਿੱਤੀ ਜਾਵੇਗੀ ਲੇਕਿਨ ਜਿੱਥੋਂ ਤੱਕ ਮੈਨੂੰ ਅੰਦਾਜ਼ਾ ਮੇਰੀਆਂ ਗੋਲੀਆਂ ਘੱਟਦੀਆਂ ਰਹੀਆਂ ਲੇਕਿਨ ਐਮ ਜੀ ਵੱਧਦੇ ਗਏ ਤਾਂ ਕਿ ਮੈਨੂੰ ਇਸ ਬਿਮਾਰੀ ਦਾ ਅਹਿਸਾਸ ਨਾ ਹੋਵੇ ਅਤੇ ਜਦੋਂ ਮੈਂ ਆਪਣੇ ਇੱਕ ਦੋਸਤ ਨਾਲ ਗੱਲ ਕੀਤੀ ਤਾਂ ਉਹਨੇ ਮੈਨੂੰ ਇੱਕੋ ਚੀਜ਼ ਦੱਸੀ ਕਿ ਜਿੰਨਾਂ ਤੂੰ ਆਪਣੇ ਸਰੀਰ ਨੂੰ ਕਸਰਤ 'ਚ ਰੱਖੇਗੀ ਓਨਾ ਹੀ ਤੇਰਾ ਗਠੀਆ ਤੋਂ ਜਲਦੀ ਆਪਣਾ ਮੁਕਤ ਗਠੀਆ ਮੁਕਤ ਹੋ ਸਕਦੀ ਹੈ ਅਤੇ ਮੈਂ ਆਪਣੇ ਦੋਸਤ ਦੀ ਮਦਦ ਦੇ ਨਾਲ ਭੰਗੜਾ ਕਰਨਾ ਸ਼ੁਰੂ ਕੀਤਾ ਕਿਉਂਕਿ ਉਹ ਵੀ ਭੰਗੜਾ ਕਰਦੀ ਸੀ ਅਸੀਂ ਦੋਨਾਂ ਨੇ ਇਕੱਠੇ ਭੰਗਣਾ ਸ਼ੁਰੂ ਕਰਤਾ ਔਰ ਭੰਗੜੇ ਨੂੰ ਮੈਂ ਸਿਰਫ ਇੱਕ ਕੁਝ ਸਮੇਂ ਤੱਕ ਸੀਮਿਤ ਨਹੀਂ ਰੱਖਿਆ ਭੰਗੜੇ ਨੂੰ ਮੈਂ ਹਮੇਸ਼ਾ ਇੱਦਾਂ ਕਰਦੀ ਰਹੀ ਕਿ ਅਗਰ ਮੈਂ ਆਪਣੇ ਘਰ 'ਚ ਫਰੀ ਬੈਠੀ ਹਾਂ ਅਗਰ ਮੈਂ ਚੱਲ ਰਹੀ ਹਾਂ ਥੋੜ੍ਹੇ ਥੋੜ੍ਹੇ ਸਟੈਪ ਉਸ ਹਿਸਾਬ ਨਾਲ ਬੰਦਾ ਕਰਦਾ ਗਿਆ ਅਗਰ ਮੈਂ ਰਸੋਈ 'ਚ ਕੋਈ ਕੰਮ ਕਰ ਰਹੀ ਹਾਂ ਤੇ ਤਾਂ ਵੀ ਭੰਗੜਾ ਕੀਤਾ ਕਿਤੇ ਵੀ ਗਾਣਾ ਚੱਲ ਰਿਹਾ ਘਰ ਦੇ ਵਿੱਚ ਭੰਗੜਾ ਸ਼ੁਰੂ ਕਰ ਦਿੱਤਾ ਔਰ ਜਿਹਦੇ ਨਾਲ ਹੌਲੀ ਹੌਲੀ ਮੇਰੇ ਸਰੀਰ ਨੂੰ ਇੱਕ ਕਸਰਤ ਦੀ ਆਦਤ ਪੈ ਗਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੱਟੋ ਘੱਟ ਦੋ ਘੰਟੇ ਭੰਗੜਾ ਹੋ ਜਾਂਦਾ ਸੀ ਅਤੇ ਬਸ ਉਸ ਭੰਗੜੇ ਦੀ ਬਦੌਲਤ ਮੈਂ ਆਪਣੇ ਆਪ ਨੂੰ ਗਠੀਆ ਮੁਕਤ ਕਰ ਪਾਈ ਹਾਂ ਔਰ ਅੱਜ ਮੈਂ ਬੜੇ ਹੀ ਸੋਹਣੇ ਤਰੀਕੇ ਨਾਲ ਮਾਨਸਿਕਤਾ ਵੀ ਮੇਰੀ ਬਿਲਕੁਲ ਤੰਦਰੁਸਤ ਹੋ ਚੁੱਕੀ ਹੈ ਧੰਨਵਾਦ